ਮੈਂ ਆਪਣੇ ਸਮਾਜ ਦੇ ਹਰੇਕ ਵਧੀਆ ਮੌਕੇ 'ਤੇ ਭੰਗੜਾ ਜਾਂ ਡਾਂਸ ਕਰਦਾ ਹਾਂ ਪਰ ਜ਼ਿਆਦਾਤਰ ਮੈਂ ਭੰਗੜਾ ਵਿਆਹ ਸ਼ਾਦੀਆਂ ਜਾਂ ਕਿਸੇ ਵਧੀਆ ਪ੍ਰੋਗਰਾਮ 'ਤੇ ਹੀ ਪਾਉਂਦਾ ਹਾਂ